ਹਲੋ ਤੁਸੀਂ ਮੈਡਮ ਮੈਮ ਮੈਂ ਨਾ ਇੱਕ ਇਨਫੋਰਮੇਸ਼ਨ ਲੈਣੀ ਸੀ ਮੈਂ ਨਾ ਆਪਣਾ ਇੱਕ ਸੇਵਿੰਗ ਅਕਾਊਂਟ ਜਿਹੜਾ ਨਾ ਉਹ ਨਿਊ ਖੁੱਲ੍ਹਵਾਉਣਾ ਚਾਹੁੰਦੀ ਹਾਂ ਅਤੇ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਚਾਹੀਦੀ ਹੈ ਕਿ ਉਹਨੂੰ ਖੁੱਲ੍ਹਵਾਉਣ ਦੇ ਲਈ ਕੀ ਕੀ ਪ੍ਰੋਸੀਜਰ ਹੈ ਉਹਦਾ ਮੇਰਾ ਨਾਮ ਨੀਤੂ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ

ਓਕੇ ਮੈਮ ਤੋ ਮੈਮ ਮਿਨੀਮਮ ਅਮਾਊਂਟ ਜੀ ਪੰਜ ਹਜ਼ਾਰ ਤੋਂ ਘੱਟ ਨਹੀਂ ਠੀਕ ਹੈ ਮੈਮ ਠੀਕ ਹੈ ਨਹੀਂ ਮੈਮ ਸੈਲਰੀ ਅਕਾਊਂਟ ਨਹੀਂ ਹੈ ਸੇਵਿੰਗ ਅਕਾਊਂਟ ਹੈ ਤੋ ਮੈਮ ਇਹਦੇ ਕੋਈ ਚਾਰਜਿਸ ਵੀ ਹੁੰਦੇ ਹੈ ਕਿ ਜਦੋਂ ਮਤਲਬ ਕਿ ਐਕਸਟ੍ਰਾ ਚਾਰਜਿਸ ਪੈਂਦੇ ਜਿਸ ਤਰ੍ਹਾਂ ਕਈ ਵਾਰੀ ਜੀ ਠੀਕ ਹੈ ਠੀਕ ਹੈ ਮੈਮ ਓਕੇ ਚਲੋ ਠੀਕ ਹੈ ਮੈਮ ਮੈਂ ਫਿਰ ਦੇਖਦੇ ਹਾਂ ਮਾਰਦੀ ਚੱਕਰ ਫਿਰ ਆਉਂਦੇ ਬੈਂਕ ਵਿੱਚ ਖਾਤਾ ਖੁੱਲ੍ਹਵਾਉਣ ਲਈ ਓਕੇ ਥੈਂਕ ਯੂ